ਮੈਂ ਆਪਣੇ ਦੋਸਤ ਦੇ ਜਨਮ ਦਿਨ 'ਤੇ ਆਪਣੇ ਦੋਸਤ ਨੂੰ ਤੋਹਫੇ ਦੇ ਵੱਜੋਂ ਇੱਕ ਕਵਿਤਾ ਲਿਖ ਕੇ ਦਿੱਤੀ ਸੀ ਜੋ ਕਿ ਉਸਦੇ ਔਰ ਪਰਿਵਾਰ ਨੂੰ ਅਤੇ ਉਸ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈ ਅਤੇ ਉਹਦੇ ਦੋਸਤਾਂ ਨੂੰ ਵੀ ਬਹੁਤ ਜ਼ਿਆਦਾ ਪਸੰਦ ਆਈ ਅਤੇ ਉਹਨਾਂ ਨੇ ਮੇਰੀ ਬਹੁਤ ਹੀ ਪ੍ਰਸੰਸਤਾ ਕਰੀ ਵੀ ਇਹ ਬਹੁਤ ਚੰਗੀ ਕਵਿਤਾ ਹੈ ਉਹਨਾਂ ਨੇ ਗਹਾਂ ਵੀ ਦੱਸਿਆ ਕਿ ਬਹੁਤ ਚੰਗੀ ਕਵਿਤਾ ਹੈ ਅਤੇ ਇਸ ਇਸ ਤੋਹਫੇ ਵੱਜੋਂ ਉਸ ਨੇ ਮੈਨੂੰ ਇੱਕ ਗਿਫਟ ਵੀ ਦਿੱਤਾ ਅਤੇ ਕਵਿਤਾ ਉਸ ਨੂੰ ਬਹੁਤ ਹੀ ਜ਼ਿਆਦਾ ਹੀ ਵਧੀਆ ਲੱਗੀ ਇਹ ਕਵਿਤਾ ਵਿੱਚ ਬਹੁਤ ਹੀ ਜਾਣਕਾਰ ਗੱਲਾਂ ਲਿਖੀਆਂ ਸਨ ਇਸ ਲਈ ਆਪਾਂ ਨੂੰ ਕੋਈ ਵੀ ਤੋਹਫਾ ਦੇਣ ਦੀ ਬਜਾਏ ਆਪਾਂ ਉਸ ਨੂੰ ਕੋਈ ਗਦ ਜਾਂ ਕਵਿਤਾ ਲਿਖ ਕੇ ਦੇਣੀ ਚਾਹੀਦੀ ਹੈ